ਘੀਆ ਮਨੁੱਖ ਨੂੰ ਹਮੇਸ਼ਾ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚਾਹੀਦਾ ਹੈ ਸਾਨੂੰ ਪੰਜਾਬ ਦੇ ਪੰਜਾਬ ਦੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਨਹੀਂ ਭੁੱਲਣਾ ਚਾਹੀਦਾ ਸਾਨੂੰ ਪੁਰਾਣੇ ਸਾਨੂੰ ਪੁਰਾਣੇ ਪੰਜਾਬ ਦੀਆਂ ਸਾਰੀਆਂ ਯਾਦਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਕਿ ਪੁਰਾਣੇ ਸਮੇਂ ਵਿੱਚ ਜਿਹੜੇ ਆਦਮੀ ਹੁੰਦੇ ਸਨ ਉਹ ਸੱਥ ਵਿੱਚ ਬੈਠ ਕੇ ਸਤ ਵਿੱਚ ਸੱਥ ਵਿੱਚ ਬੈਠ ਕੇ ਪਿੰਡ ਦੇ ਲੋਕਾਂ ਦੀਆਂ ਗੱਲਾਂ ਅਤੇ ਤਾਸ਼ ਖੇਡਦੇ ਸਨ ਅਤੇ ਪਿੰਡ ਦੇ ਭਲਾਈ ਦੀਆਂ ਗੱਲਾਂ ਕਰਦੇ ਸਨ ਜਿਹੜੀਆਂ ਔਰਤਾਂ ਹੁੰਦੀਆਂ ਸਨ ਉਹ ਘਰ ਦਾ ਕੰਮ ਜਿਵੇਂ ਕਿ ਕਢਾਈ ਬੁਣਾਈ ਕਢਾਈ ਬੁਣਾਈ ਫੁਲਕਾਰੀ ਕੱਢਣੀ ਸ਼ੀਸ਼ਿਆਂ ਦਾ ਕੰਮ ਅਤੇ ਜਿਹੜੇ ਪੁਰਾਣੇ ਕੋਠੇ ਜਾਂ ਪੁਰਾਣੇ ਕੋਠੇ ਜਾਂ ਪਰ ਪੁਰਾਣੇ ਕੋਠੇ ਜਾਂ ਫਰਸ਼ਾਂ ਨੂੰ ਮੱਝਾਂ ਦੇ ਗੋਹੇ ਨਾਲ ਲਿਪਦੀਆਂ ਸਨ ਹੋਰ ਅਤੇ ਹੋਰ ਵੀ ਕਈ ਘਰ ਦੇ ਕੰਮ ਕਰਦੇ ਸਨ ਪਹਿਲਾਂ ਪੰਜਾਬ ਦੇ ਪੰਜਾਬ ਪਹਿਲਾਂ ਪੰਜਾਬ ਦੀ ਸਵੇਰ ਕੁੱਕੜ ਦੇ ਬੋਲਣ ਨਾਲ ਸ਼ੁਰੂ ਹੁੰਦੀ ਸੀ ਅਤੇ ਫਿਰ ਸਾਰੇ ਲੋਕ ਉੱਠਦੇ ਸਨ ਪਰ ਹੁਣ ਪਰ ਹੁਣ ਇਹ ਸਭ ਬਦਲ ਗਿਆ ਹੈ ਪਰ ਪਰ ਮੈਂ ਹਜੇ ਵੀ ਆਪਣੀਆਂ ਜੜ੍ਹਾਂ ਨਾਲ ਅ ਜੁੜੀ ਹੋਈ ਹਾਂ ਮੈਂ ਅਤੇ ਮੇਰੀ ਮਾਤਾ ਕਢਾਈ ਬੁਣਾਈ ਦਰੀਆਂ ਆਦਿ ਬੁਣਦੀਆਂ ਬੁਣਦੇ ਹਨ ਸਾਡੇ ਘਰ ਵਿੱਚ ਇੱਕ ਕੱਚਾ ਕਮਰਾ ਹੈ ਜਿਸ ਨੂੰ ਮੇਰੀ ਮਾਤਾ ਜੀ ਲਿਪਦੇ ਹਨ ਇਸ ਇਸ ਤਰ੍ਹਾਂ ਮੈਂ ਆਪਣੀਆਂ ਅਸੀਂ ਇਸ ਤਰ੍ਹਾਂ ਮੈਂ ਆਪਣੀਆਂ ਪੁਰਾਣੀਆਂ ਜੜ੍ਹਾਂ ਨਾਲ ਜੁੜੀ ਹੋਈ ਹਾਂ